ਸਮੇਂ ਦੇ ਨਾਲ ਪੰਜਾਬ ਦੇ ਸਮਾਜ ਵਿੱਚ ਔਰਤਾਂ ਦੀ ਭੂਮਿਕਾ ਹੁਣ ਕਾਫੀ ਬਦਲ ਗਈ ਹੈ ਹੁਣ ਦੀਆਂ ਔਰਤਾਂ ਕਾਫੀ ਪੜ੍ਹ ਲਿਖ ਗਈਆਂ ਹਨ ਅਤੇ ਉਹ ਸਪੋਰਟਸ ਵੱਲ ਵੀ ਜਾ ਰਹੀਆਂ ਹਨ ਅਤੇ ਸਟੱਡੀ ਲੈਵਲ 'ਤੇ ਜੋਬ ਵੀ ਅੱਛੀ ਕਰ ਰਹੀਆਂ ਹਨ ਕੋਈ ਜੱਜ ਬਣ ਰਹੀ ਆ ਕੋਈ ਸੀ ਐੱਮ ਬਣ ਰਹੇ ਆ ਪੜ੍ਹ ਕੇ ਅੱਛੇ ਅੱਛੇ ਅਹੁਦਿਆਂ 'ਤੇ ਉਹ ਜੋਬ ਕਰ ਰਹੇ ਹਾਂ ਜਦ ਕਿ ਦੇਖੀਏ ਪਹਿਲੇ ਸਮੇਂ 'ਚ ਇਹ ਚੀਜ਼ਾਂ ਨਹੀਂ ਸੀ ਹੁਣ ਦੀ ਔਰਤ ਹਰ ਤਰ੍ਹਾਂ ਦਾ ਕੰਮ ਕਰ ਸਕਦੀ ਆ ਉਹ ਪੜ੍ਹੀ ਲਿਖੀ ਹੋਣ ਦੇ ਨਾਲ ਨਾਲ ਆਪਣੇ ਆਪ ਨੂੰ ਹਰੇਕ ਪਾਸੇ ਪਾਰਟੀਸਪੇਸ਼ਨ ਵੀ ਕਰ ਰਹੀ ਆ ਉਹ ਸਪੋਰਟਸ ਵਿੱਚ ਵੀ ਉਹ ਕਾਫੀ ਸਾਡੇ ਦੇਸ਼ ਵਿੱਚ ਦੇਖਿਆ ਜਾਵੇ ਜਾਂ ਪੰਜਾਬ ਵਿੱਚ ਦੇਖਿਆ ਜਾਵੇ ਸਾਰੇ ਪਾਸੇ ਔਰਤਾਂ ਅੱਗੇ ਹਨ ਉਹ ਆਪਣੇ ਘਰ ਵਿੱਚ ਵੀ ਸਹੀ ਭੂਮਿਕਾ ਨਿਭਾਅ ਰਹੀ ਆ ਅਤੇ ਆਪਣੇ ਜਿੱਥੇ ਉਹ ਕੰਮ ਕਰਦੇ ਆ ਦਫ਼ਤਰ ਹੋਏ ਚਾਹੇ ਉਹ ਸਕੂਲ ਹੋਵੇ ਕੋਲਜ ਹੋਵੇ ਹਰ ਪਾਸੇ ਉਹ ਅੱਛੀ ਭੂਮਿਕਾ ਨਿਭਾਅ ਰਹੀ ਆ ਔਰ ਅੱਗੇ ਨਾਲੋਂ ਕਾਫੀ ਉਹਨਾਂ ਦੀ ਜੋ ਸਥਿਤੀ ਆ ਸੁਧਰ ਗਈ ਆ ਹੁਣ ਪੰਜਾਬ ਦੇ ਸਮਾਜ ਵਿੱਚ ਔਰਤਾਂ ਦੀ ਥੋੜ੍ਹਾ ਲੈਵਲ ਠੀਕ ਹੋ ਗਿਆ ਹੈ ਜੇ ਦੇਖਿਆ ਜਾਵੇ